ਪੰਜਾਬ ਵਿੱਚ ਰੋਜ਼ੀ ਰੋਟੀ ਦਾ ਇੱਕ ਹੀ ਮਾਧਿਅਮ ਹੈ ਇਹ ਉਹ ਹੈ ਖੇਤੀਬਾੜੀ ਅਤੇ ਆਪਣਾ ਕਾਰੋਬਾਰ ਪਰ ਅੱਜ ਦੇ ਸਮੇਂ ਦੇ ਵਿੱਚ ਬੱਚੇ ਆਪਣੇ ਆਪਣੇ ਘਰ ਦੀ ਜ਼ਮੀਨ ਖੇਤੀਬਾੜੀ ਵੇਚ ਕੇ ਦੇਸ਼ ਵਿਦੇਸ਼ ਜਾ ਕੇ ਆਪਣਾ ਸਥਾਨ ਗ੍ਰਹਿਣ ਕਰ ਰਹੇ ਹਨ ਉਹਨਾਂ ਨੂੰ ਇੰਝ ਲੱਗਦਾ ਹੈ ਕਿ ਉੱਥੇ ਹੀ ਰੋਜ਼ੀ ਰੋਟੀ ਉਹਨਾਂ ਨੂੰ ਮਿਲੇਗੀ